ਮੈਨੂੰ ਸ਼ੁਰੂ ਤੋਂ ਹੀ ਫੋਟੋਗ੍ਰਾਫ਼ੀ ਦਾ ਬਹੁਤ ਸ਼ੌਂਕ ਸੀ ਇੱਕ ਵਾਰੀ ਮੈਨੂੰ ਆਪਣੇ ਦੋਸਤ ਦੇ ਕੈਮਰੇ ਨਾਲ ਫੋਟੋ ਖਿੱਚਣ ਦਾ ਮੌਕਾ ਮਿਲਿਆ ਮੈਂ ਉਸਦਾ ਕੈਮਰਾ ਲੈ ਕੇ ਸ਼੍ਰੀ ਦਰਬਾਰ ਸਾਹਿਬ ਗਿਆ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਫੋਟੋ ਕਿਸੇ ਧਾਰਮਿਕ ਸਥਾਨ ਦੀ ਹੀ ਖਿੱਚਣਾ ਚਾਹੁੰਦਾ ਸੀ ਕੈਮਰਾ ਔਨ ਕਰਕੇ ਦਰਬਾਰ ਸਾਹਿਬ ਦੇ ਬਾਹਰ ਮੱਥਾ ਟੇਕ ਕੇ ਮੈਂ ਇੱਕ ਵਧੀਆ ਜਿਹਾ ਕਲਿੱਪ ਦਰਬਾਰ ਸਾਹਿਬ ਦਾ ਫੋਟੋ ਖਿੱਚਿਆ ਇਹ ਫੋਟੋ ਮੇਰੇ ਅੱਜ ਵੀ ਘਰ ਦੇ ਵਿੱਚ ਬੜੇ ਸਾਰੇ ਫਰੇਮ ਦੇ ਵਿੱਚ ਲੱਗੀ ਹੋਈ ਹੈ ਜਿਸ ਦੇ ਵਿੱਚ ਮੈਂ ਚਾਰੇ ਪਾਸੇ ਰੰਗਦਾਰ ਐੱਲ ਈ ਡੀ ਲਗਾਏ ਹਨ ਇਹ ਫੋਟੋ ਮੈਂ ਬਾਰਾਂ ਸਾਲ ਦੀ ਉਮਰ ਵਿੱਚ ਖਿੱਚੀ ਸੀ